ਸਾਡੇ ਪਿੰਡ ਵਿੱਚ ਖੇਤੀਬਾੜੀ ਡੈਅਰੀ ਫਾਰਮ ਅਤੇ ਪਸ਼ੂ ਪਾਲਣ ਦਾ ਬਿਜਨਸ ਕੀਤਾ ਜਾਂਦਾ ਹੈ ਜਿਸ ਨਾਲ ਲੋਕ ਆਪਣੇ ਬਿਜਨਸ ਕਰਕੇ ਲੋਕ ਆਪਣਾ ਮੁਨਾਫਾ ਕਮਾਉਂਦੇ ਹਨ ਰੋਜ਼ਮਰਾਂ ਦੀਆਂ ਜ਼ਿੰਦਗੀ ਦੀਆਂ ਵਰਤੋਆਂ ਕਰ ਵਰਤੋਂ ਲਈ ਪੈਸਾ ਕਮਾਉਂਦੇ ਹਨ ਖੇਤੀਬਾੜੀ ਵਿੱਚ ਲੋਕ ਫਸਲਾਂ ਉਗਾਉਂਦੇ ਹਨ ਸਬਜ਼ੀਆਂ ਉਗਾਉਂਦੇ ਹਨ ਇਹਨਾਂ ਨੂੰ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਜਾ ਕੇ ਵੇਚ ਕੇ ਆਉਂਦੇ ਹਨ ਅਤੇ ਵੇਚ ਕੇ ਆ ਕੇ ਆਪਣਾ ਬਿਜਨਸ ਕਰਦੇ ਹਨ ਅਤੇ ਪੈਸਾ ਕਮਾਉਂਦੇ ਹਨ ਪਸ਼ੂ ਪਾਲਣ ਨਾਲ ਲੋਕ ਦੁੱਧ ਦੀ ਦੁੱਧ ਦੀ ਪੈਦਾਵਾਰ ਕਰਦੇ ਹਨ ਅਤੇ ਅ ਡਾਇਰੀਆਂ ਵਿੱਚ ਵੇਚ ਕੇ ਆਉਂਦੇ ਹਨ ਅਤੇ ਆਪਣਾ ਮੁਨਾਫਾ ਕਮਾਉਂਦੇ ਹਨ ਅਤੇ ਸਬ ਹੋਟ ਸ਼ਹਿਰਾਂ ਦੇ ਹੋਟਲਾਂ ਵਿੱਚ ਜਾ ਕੇ ਦੁੱਧ ਵੇਚ ਕੇ ਆਉਂਦੇ ਹਨ ਜਿ ਜਿਸ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਸਹਾਇਤਾ ਹੁੰਦੀ ਹੈ ਲੋਕ ਹੋਰਾਂ ਦੀ ਵੀ ਅੱਗੇ ਹੈਲਪ ਕਰਦੇ ਹਨ ਜਿਸ ਨਾਲ ਬੇਯੋਗ ਬੇਰੁਜ਼ਗਾਰ ਲੋਕਾਂ ਨੂੰ ਵੀ ਰੁਜ਼ਗਾਰ ਮਿਲਦਾ ਹੈ ਬ ਖੇਤੀਬਾੜੀ ਨਾਲ ਪਸ਼ੂ ਪਾਲਣ ਨਾਲ ਡੈਅਰੀ ਫਾਰਮ ਨਾਲ ਲੋਕ ਬਹੁਤ ਸਾਰੇ ਰੁਜ਼ਗਾਰ ਪੈਦਾ ਕਰਦੇ ਹਨ ਅਤੇ ਬੇਰੁਜ਼ਗਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਸਾਡੇ ਪਿੰਡ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਬਿਜਨਸ ਕਰਨ ਨਾਲ ਲੋਕਾਂ ਨੂੰ ਤਰੱਕੀ ਹੋਈ ਹੈ ਲੋਕ ਆਪਣੇ ਰੋਜ਼ਮਰਾਂ ਦੇ ਖਰਚਿਆਂ ਨੂੰ ਲੈ ਕੇ ਜੋ ਪਰੇਸ਼ਾਨ ਰਹਿੰਦੇ ਹਨ ਉਹਨਾਂ ਦੀ ਉਹਨਾਂ ਨੂੰ ਉਹਨਾਂ ਨੂੰ ਵਿੱਚ ਉਹਨਾਂ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਹੋਇਆ ਹੈ ਜਿਸ ਨਾਲ ਲੋਕ ਆਪਣੇ ਘਰ ਦੇ ਖਰਚਿਆਂ ਤੋਂ ਤੰਗ ਹੋ ਕੇ ਜੋ ਹੁੰਦੇ ਹਨ ਉਹਨਾਂ ਨੂੰ ਉਹਨਾਂ ਨਾਲ ਉਹ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਹਨ ਜਿਸ ਨਾਲ ਲੋਕ ਬਿਜਨਸ ਕਰਕੇ ਤਰੱਕੀ ਕਰਦੇ ਹਨ ਸਾਡੇ ਪਿੰਡ ਵਿੱਚ ਡੈਅਰੀ ਫਾਰਮ ਹੈ ਜਿਸ ਨਾਲ ਜਿਸ ਵਿੱਚ ਲੋਕ ਦੁੱਧ ਪਾ ਕੇ ਆਉਂਦੇ ਹਨ ਅਤੇ ਅੱਗੇ ਤੋਂ ਅੱਗੇ ਵੇਚਦੇ ਹਨ ਹੋਟਲਾਂ ਵਿੱਚ ਘਰਾਂ ਵਿੱਚ ਸ਼ਹਿਰਾਂ ਵਿੱਚ ਜਾ ਜਾ ਕੇ ਆਪਣੇ ਦੁੱਧ ਦੀ ਪੈਦਾਵਾਰ ਦੁੱਧ ਨੂੰ ਵੇਚ ਕੇ ਆਉਂਦੇ ਹਨ ਅਤੇ ਆਪਣੇ ਘਰ ਲਈ ਮੁਨਾਫਾ ਕਮਾਉਂਦੇ ਹਨ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਸਬਜ਼ੀਆਂ ਫਲ਼ ਉਗਾਉਂਦੇ ਹਨ ਖੇਤੀਬਾੜੀ ਨਾਲ ਖੇਤੀਬਾੜੀ ਨਾਲ ਅਤੇ ਜਾ ਕੇ ਵੇਚ ਕੇ ਆਉਂਦੇ ਹਨ ਸ਼ਹਿਰਾਂ ਵਿੱਚ ਚੰਗੇ ਭਾਅ ਵਿੱਚ ਅਤੇ ਬਹੁਤ ਸਾਰੀ ਉਹਨਾਂ ਦੀ ਜ਼ਿੰਦਗੀ ਇਸ ਚੀਜ਼ ਨਾਲ ਪ੍ਰਭਾਵਿਤ ਹੋਈ ਹੈ ਬਹੁਤ ਜ਼ਿਆਦਾ ਉਹਨਾਂ ਨੂੰ ਮੁਨਾਫਾ ਹੋਇਆ ਬਹੁਤ ਜ਼ਿਆਦਾ ਚੰਗੀ ਪੈਦਾਵਾਰ ਹੋਈ ਆ ਉਹਨਾਂ ਦੀ ਜ਼ਿੰਦਗੀ ਵਿੱਚ